ਪੰਜਾਬ ਵਿੱਚ ਬਹੁਤ ਸਾਰੇ ਅਜਾਇਬ ਘਰ ਹਨ ਇਹਨਾਂ ਇਹਨਾਂ ਵਿੱਚੋਂ ਦਿਉਣ ਅਤੇ ਬੱਗਿਆਣਾ ਪ੍ਰਮੁੱਖ ਹਨ ਜੋ ਕਿ ਸਾਡੇ ਇਲਾਕੇ ਦੇ ਨੇੜੇ ਪੈਂਦੇ ਹਨ ਦਿਓਣ ਅਜਾਇਬ ਘਰ ਵਿੱਚ ਪੁਰਾਣੀਆਂ ਵਿਰਾਸਤ ਦੀਆਂ ਚੀਜ਼ਾਂ ਸਾਂਭੀਆਂ ਹੋਈਆਂ ਹਨ ਜਿਵੇਂ ਪੱਖੀਆਂ ਚੱਕੀਆਂ ਚਰਖੇ ਫੁੱਲਕਾਰੀਆਂ ਕਢਾਈ ਵਾਲੀਆਂ ਚਾਦਰਾਂ ਹਨ ਜਿਹਨਾਂ ਨੂੰ ਵੇਖ ਕੇ ਬੱਚਿਆਂ ਨੂੰ ਪੁਰਾਣੀ ਵਿਰਾਸਤ ਬਾਰੇ ਪਤਾ ਲੱਗਦਾ ਹੈ ਅਸੀਂ ਅਕਸਰ ਉੱਥੇ ਜਾਂਦੇ ਰਹਿੰਦੇ ਹਾਂ ਅਤੇ ਬੱਗਿਆਣਾ ਅਜਾਇਬ ਘਰ ਵਿੱਚ ਸਿੱਖਾਂ ਦੀਆਂ ਯਾਦਾਂ ਸਾਂਭੀਆਂ ਹੋਈਆਂ ਹਨ ਜੋ ਪੁਰਾਣੇ ਸਮੇਂ ਵਿੱਚ ਜਦੋਂ ਯੁੱਧ ਹੁੰਦੇ ਸਨ ਤਾਂ ਸਿੱਖ ਨਾਲ ਲੈ ਕੇ ਜਾਂਦੇ ਸਨ ਜਿਵੇਂ ਤਲਵਾਰਾਂ ਅਤੇ ਸਿੱਖ ਇਤਿਹਾਸ ਗੁਰੂ ਗ੍ਰੰਥ ਸਾਹਿਬ ਆਦਿ ਜਿਹਨਾਂ ਨੂੰ ਵੇਖ ਕੇ ਬੱਚਿਆਂ ਨੂੰ ਸਿੱਖ ਇਤਿਹਾਸ ਬਾਰੇ ਪਤਾ ਲੱਗਦਾ ਹੈ ਅਸੀਂ ਉੱਥੇ ਵੀ ਅਕਸਰ ਜਾਂਦੇ ਰਹਿੰਦੇ ਹਾਂ